ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਭਾਅ ਜੀ ਮਤਲਵ ਅਮਨ ਭਾਅ ਜੀ ਨੇ ਥੋਨੂੰ ਦਿੱਤਾ ਨੰਬਰ ਕੀ ਤੁਸੀਂ ਪੰਜਾਬ ਘੁੰਮਣਾ ਹਨਾ ਅੱਛਾ ਅੱਛਾ ਜੀ ਭਾਅ ਜੀ ਪੰਜਾਬ ਵਿੱਚ ਜਦੋਂ ਘੁੰਮਣ ਨੂੰ ਜਗ੍ਹਾ ਦਾ ਕਾਫੀ ਹੈਗੀਆਂ ਤੇ ਜਿਵੇਂ ਆਪਾਂ ਅੰਮ੍ਰਿਤਸਰ ਤੋਂ ਕਰ ਲਾਂਗੇ ਸਟਾਰਟ ਜਿੱਦਾਂ ਉਥੋਂ ਗੋਲਡਨ ਟੈਂਪਲ ਹੈਗਾ ਅੰਮ੍ਰਿਤਸਰ ਜਲਿਆਂ ਵਾਲਾ ਬਾਗ ਜਿੱਥੇ ਆਪਣਾ ਸਾਰਾ ਹਨਾ ਸਾਕਾ ਹੋਇਆ ਸੀ ਉਹਦਾ ਸਾਰਾ ਹੀ ਉੱਥੇ ਆਪਣੇ ਪਿਆ ਹੈਗਾ ਤੇ ਹਿਸਟਰੀ ਸਾਰੀ ਤੇ ਬਾਅਦ ਹੁਣ ਤਾਂ ਉਧਰ ਕਰਤਾਰਪੁਰ ਕੋਰੀਡੋਰ ਵੀ ਖੁੱਲ ਗਿਆ ਲਾਂਘਾ ਤੇ ਉੱਥੇ ਉੱਥੇ ਵੀ ਜਾ ਸਕਦੇ ਤੁਸੀਂ ਤੇ ਉਧਰ ਫਿਰ ਪੈ ਜਾਂਦਾ ਪਾਕਿਸਤਾਨ ਵਿੱਚ ਹੀ ਉਹ ਉਧਰ ਦਾ ਮਤਲਬ ਵੀ ਮਿਲੀ ਜਾਂਦਾ ਹੈਗਾ ਪਾਸ ਪੁਸ ਬਣੀ ਜਾਂਦੇ ਹੈਗੇ ਉਸ ਤੋਂ ਬਾਅਦ ਇਧਰ ਆਪਣੇ ਆਨੰਦਪੁਰ ਸਾਹਿਬ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਦੀ ਸਥਾਪਨਾ ਕੀਤੀ ਸੀ ਤੇ ਉੱਥੇ ਹੁਣ ਪੰਜਾਬ ਸਰਕਾਰ ਤੇ ਉਹ ਉੱਥੇ ਹੁਣ ਪੰਜਾਬ ਸਰ ਸਰਕਾਰ ਨੇ ਉੱਥੇ ਹੁਣ ਪੰਜਾਬ ਸਰਕਾਰ ਨੇ ਜਿੱਦਾਂ ਵਿਰਾਸਤ ਏ ਖਾਲਸਾ ਜੀ ਅਜੂਬਾ ਬਣਾਇਆ ਸੀਗਾ ਉਹ ਵੀ ਘੁੰਮਣ ਲਈ ਭਾਜੀ ਬਹੁਤ ਵਧੀਆ ਹੈਗਾ ਉੱਥੇ ਸਾਨੂੰ ਆਪਣੇ ਇੱਕ ਇਤਿਹਾਸ ਹਾਂਜੀ ਹਾਂਜੀ ਭਾਅ ਜੀ ਟਿਕਟ ਥੋੜੀ ਬਹੁਤੀ ਹੁੰਦੀ ਹੈ ਕੋਈ ਇਦਾਂ ਉਹ ਨਹੀਂ ਸੀ ਹੈਗਾ ਹਾਂਜੀ ਹਾਂਜੀ ਪਹਿਲਾ ਰਜਿਸਟਰੇਸ਼ਨ ਹੁੰਦੀ ਭਾਅ ਜੀ ਵਧੀਆ ਆਨਲਾਈਨ ਰਜਿਸਟਰੇਸ਼ਨ ਚੱਲਦੀ ਉਹਦੀ ਤੇ ਉਹ ਕੋਈ ਨਹੀਂ ਉਹ ਕਰਵਾ ਦਾਂਗੇ ਤੁਸੀਂ ਦੱਸਦੇ ਹੋਨਾ ਜਦੋਂ ਵੀ ਹੋਇਆ ਤੁਹਾਡਾ ਕੀ ਜਾਣ ਦਾ ਪਲੈਨ ਬਣਿਆ ਤੇ ਭਾਅ ਜੀ ਕੋਈ ਨਹੀਂ ਸੀ ਮੈਨੂੰ ਫੋਨ ਕਰ ਲਿਓ ਇਧਰ ਨੂੰ ਜਦ ਆਏ ਜਾਣ ਲੱਗੇ ਹਨਾ ਅੰਮ੍ਰਿਤਸਰ ਵੱਲ ਨੂੰ ਤੇ ਮੈਂ ਤੁਹਾਨੂੰ ਫਿਰ ਦੱਸ ਦਿੰਦਾ ਨਾ ਜਗ੍ਹਾ ਜਿੱਥੇ ਮੈਂ ਹੋਇਆ

ਹੋਰ ਭਾਅ ਜੀ ਚੰਡੀਗੜ੍ਹ ਤੁਸੀਂ ਬੈਠੇ ਹੀ ਹ ਚੰਡੀਗੜ੍ਹ ਘੁੰਮ ਲਓ ਇਥੇ ਕਾਫੀ ਜਗਹਾ ਵਧੀਆ ਹੈਗੀਆਂ ਜਿਦਾਂ ਇੱਥੇ ਨਾ ਹਾਂਜੀ ਹਾਂਜੀ

ਹਾਂਜੀ ਹਾਂਜੀ ਐਥੇ ਰੋਕ ਗਾਰਡਨ ਹੈਗਾ ਰੋਜ ਗਾਰਡਨ ਹੈਗਾ ਤੇ ਇਹ ਮੋਲ ਐਲਾਂਟੇ ਮੋਲ ਹੈਗਾ ਇਥੇ ਤੇ ਕਾਫੀ ਜਗ੍ਹਾ ਹੈਗੀਆਂ ਸੁਖਨਾ ਲੇਕ ਵਲ ਘੁੰਮ ਘੰਮ ਲਿਓ ਠੀਕ ਐ ਜੀ ਠੀਕ ਆ ਦੱਸ ਦਿਓ ਮੈਨੂੰ ਓਕੇ